ਵਧੇਰੇ ਪੈਸਾ ਬਣਉਣ ਲਈ ਕੁਝ ਰਣਨੀਤੀਆਂ ਹੋ ਗਈਆਂ ਜਿੱਦਾਂ ਕਿ ਅਸੀਂ ਪੈਸਾ ਬਚਾਉਣ ਲਈ ਹੈ ਨਾ ਕੁਝ ਮਤਲਬ ਸੇਵਿੰਗ ਅਕਾਂਉਂਟ ਖੁੱਲਾਉਂਦੇ ਹਾਂ ਅਸੀਂ ਬੈਂਕ ਦੇ ਵਿੱਚ ਸੇਵਿੰਗ ਅਕਾਂਉਂਟ ਖੁੱਲ੍ਹਾ ਕੇ ਉਹਦੇ ਵਿੱਚ ਕੁਝ ਆਪਣੀਆ ਸੇਵਿੰਗਸ ਪਾਈ ਜਾਂਦੇ ਹਾਂ ਅਤੇ ਅਸੀਂ ਹੈ ਨਾ ਬੈਂਕ ਦੇ ਵਿੱਚ ਜਾ ਕੇ ਹੈ ਨਾ ਕੋਈ ਵੀ ਸਾਨੂੰ ਪੈਸਿਆਂ ਦੀ ਲੋੜ ਹੁੰਦੀ ਹੈ ਤਾਂ ਅਸੀਂ ਡੈਬਿਟ ਕਾਰਡ ਵਗੈਰਾ ਬਣਵਾ ਲੈਂਦੇ ਹਾਂ ਅਤੇ ਅਸੀਂ ਬੈਂਕ ਤੋਂ ਲੌਨ ਵਗੈਰਾ ਲੈ ਲੈਂਦੇ ਹਾਂ ਜਾਂ ਫਿਰ ਅਸੀਂ ਐੱਲ ਆਈ ਸੀ ਵਾਲੇ ਕਿਸੇ ਵੀ ਆ ਆਫ਼ਿਸਰ ਕੋਲ ਜਾਂਦੇ ਹਾਂ ਅਤੇ ਉਹਦੀ ਸਲਾਹ ਲੈ ਲੈਂਦੇ ਅ ਅਤੇ ਉਹਦੇ ਰੂਲਸ ਔਰ ਰੇਗੁਲੇਸ਼ਨ ਨੂੰ ਅਸੀਂ ਫ਼ੌਲੋ ਕਰਦੇ ਹਾਂ